ਮੇਰੀ ਪਹਿਲੀ ਵਾਰ ਗਾਣ ਦੀ ਰੁਚੀ ਮੈਨੂੰ ਹੀ ਨਹੀਂ ਪਤਾ ਕਦੋਂ ਸ਼ੁਰੂ ਹੋਈ ਪਰ ਜਦੋਂ ਮੈਂ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਹੋਇਆ ਕਰਦੇ ਸੀ ਉਦੋਂ ਸੁਣਦੇ ਸੀਗੇ ਦੋਸਤਾਂ ਨੂੰ ਸਹੇਲੀਆਂ ਨੂੰ ਗਾਂਦੇ ਹੋਏ ਤਾਂ ਵਧੀਆ ਲੱਗਦਾ ਸੀ ਲੱਗਦਾ ਸੀਗਾ ਕਿ ਸਾਨੂੰ ਵੀ ਗਾਣਾ ਚਾਹੀਦਾ ਹੈ ਅਤੇ ਕਦੇ ਟੀਵੀਸ ਦੇ ਵਿੱਚ ਕੋਈ ਗਾਣਾ ਸੁਣਨਾ ਜਾਂ ਪੁਰਾਣਾ ਮਿਊਜਿਕ ਸੁਣਨਾ ਅਤੇ ਉਹ ਮਨ ਨੂੰ ਬੜਾ ਸਕੂਨ ਮਿਲਦਾ ਸੀ ਉਦੋਂ ਵੀ ਲੱਗਦਾ ਸੀਗਾ ਕਿ ਕਾਸ਼ ਅਸੀਂ ਵੀ ਇੱਦਾਂ ਗਾ ਸਕੀਏ ਅਸੀਂ ਵੀ ਜਦੋਂ ਗਾਈਏ ਸਾਡੀ ਆਵਾਜ਼ ਸੁਣ ਕੇ ਕਿਸੇ ਹੋਰ ਦੇ ਮਨ ਨੂੰ ਸਕੂਨ ਮਿਲੇ ਉਦੋਂ ਤੋਂ ਗਾਣ ਦੀ ਰੁਚੀ ਹੋਈ ਅਤੇ ਬਹੁਤ ਛੋਟੀ ਏਜ ਸੀ ਸ਼ਾਇਦ ਉਦੋਂ ਮੈਂ ਛੇਵੀਂ ਸੱਤਵੀਂ ਕਲਾਸ ਵਿੱਚ ਪੜ੍ਹਦੀ ਸੀ ਜਦੋਂ ਮੈਂ ਪਹਿਲੀ ਵਾਰ ਸਟੇਜ 'ਤੇ ਗਾਇਆ ਸੀ ਮੇਰੀ ਫਰੈਂਡ ਦੇ ਨਾਲ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਟੀਚਰਸ ਨੇ ਮੈਨੂੰ ਬਹੁਤ ਸਰਾਹਨਾ ਦਿੱਤੀ ਇਸ ਚੀਜ਼ ਲਈ ਕਿ ਆਵਾਜ਼ ਅੱਛੀ ਹੈ ਤੁਸੀਂ ਇਸਦੇ ਗਾ ਸਕਦੇ ਹੋ ਕੋਸ਼ਿਸ਼ ਕਰ ਸਕਦੇ ਹੋ ਅਤੇ ਉਸ ਤੋਂ ਪਹਿਲਾਂ ਇੱਕ ਵਾਰ ਇੱਦਾਂ ਸੀਗਾ ਕਿ ਅਸੀਂ ਪ ਇੱਕ ਪੰਜਾਬੀ ਆਪਣਾ ਗੁਰਬਾਣੀ ਦਾ ਗੀਤ ਗਾਇਆ ਅਤੇ ਉਹਦੇ ਨਾਲ ਵੀ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਉਹ ਗਾ ਗੀਤ ਮੈਨੂੰ ਨਹੀਂ ਸੀ ਆਉਂਦਾ ਪਰ ਮੈਂ ਆਪਣੇ ਯਾਰ ਬੇਲੀਆਂ ਨਾਲ ਬਹਿ ਕੇ ਉਹਨੂੰ ਸੁਣਿਆ ਅਤੇ ਫਿਰ ਉਹਨਾਂ ਨੇ ਜਦੋਂ ਗਾਇਆ ਉਹਦੇ ਨਾਲ ਆਪਣੇ ਆਪ ਨੂੰ ਮੈਚ ਕਰਨ ਦੀ ਕੋਸ਼ਿਸ਼ ਕੀਤੀ ਇੱਦਾਂ ਫਸਟ ਟਾਈਮ ਮੈਂ ਗਾਇਆ ਸਟੇਜ 'ਤੇ ਅਤੇ ਮੈਨੂੰ ਬਹੁਤ ਅੱਛਾ ਲੱਗਿਆ ਹੁਣ ਮੈਂ ਗਾਣਾ ਤਾਂ ਬੰਦ ਕਰਤਾ ਕਿਉਂਕਿ ਹੁਣ ਉਮਰ ਉਸ ਪੜਾਵ 'ਤੇ ਅ ਅਸੀਂ ਨਹੀਂ ਪਹਿਲਾਂ ਕਾਲਜ ਦੇ ਸਮੇਂ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਸਾਰੇ ਫੈਸਟੀਵਲ ਹੁੰਦੇ ਸੀਗੇ ਸਕੂਲ 'ਚ ਸੈਲੀਬਰੇਟ ਹੁੰਦੇ ਸੀ ਅਸੀਂ ਗਾਂਦੇ ਸੀ ਅਸੀਂ ਇੰਜੋਏ ਕਰਦੇ ਸੀਗੇ ਅੱਜ ਦੇ ਟਾਈਮ 'ਤੇ ਹੁਣ ਲਾਈਫ ਸਟਾਈਲ ਥੋੜ੍ਹਾ ਡਿਫਰੈਂਟ ਹੋ ਗਿਆ ਅਸੀਂ ਸਕੂਲ 'ਚੋਂ ਨਿਕਲ ਚੁੱਕੇ ਆਂ ਇੱਕ ਫੈਮਿਲੀ ਦੇ ਵਿੱਚ ਇੱਕ ਘਰ ਸੰਭਾਲ ਰਹੀ ਹਾਂ ਮੈਂ ਇੱਕ ਗ੍ਰਹਿਣੀ ਅਤੇ ਕਦੇ ਬੈਠ ਕੇ ਮਨ ਜਦੋਂ ਦਿਲ ਕਰਦਾ ਉਦੋਂ ਜ਼ਰੂਰ ਪੁਰਾਣੇ ਗਾਣੇ ਗੁਣਗੁਣਾਨੀ ਆਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਲੱਗਦਾ ਕਿ ਹਾਂ ਮੈਂ ਕਦੇ ਨਾ ਕਦੇ ਵੀ ਗਾਣ ਦੇ ਵਿੱਚ ਜੇ ਚਾਹਵਾਂ ਤਾਂ ਆਪਣੇ ਆਪ ਨੂੰ ਨਿਖਾਰ ਕੇ ਥੋੜ੍ਹਾ ਹੋਰ ਉੱਪਰ ਲੈ ਜਾ ਸਕਦੀ ਹਾਂ ਥੈਂਕ ਯੂ